ਮੈਂ ਨਾ ਇੱਕ ਦਿਨ ਨਾ ਸੂਟ ਮੰਗਵਾਇਆ ਔਨਲਾਈਨ ਪੰਜ ਸੌ ਰੁਪਏ ਦਾ ਉਹ ਬਹੁਤ ਵਧੀਆ ਲੱਗਿਆ ਸਾਰੇ ਪੁੱਛਦੇ ਰਹੇ ਕਿੱਥੇ ਤੋਂ ਲਿਆਂਦਾ ਕਿੱਥੇ ਤੋਂ ਲਿਆਂਦਾ ਉਹ ਰੰਗ ਵੀ ਬੜਾ ਸੋਹਣਾ ਲੱਗਿਆ ਸਾਰੇ ਪੁੱਛਦੇ ਰਹੇ ਮੈਨੂੰ ਜਦ ਮੈਂ ਪਾਇਆ ਤਾਂ ਉਹ ਬਹੁਤ ਹੀ ਜ਼ਿਆਦਾ ਵਧੀਆਂ ਲੱਗਿਆ